ਯੋਗਾ ਗੁਰੂ ਸਾਡੇ ਇੰਡੀਆ ਦੇ ਵਿੱਚ ਬਾਬਾ ਰਾਮਦੇਵ ਜੀ ਨੇ ਉਹਨਾਂ ਨੇ ਬਹੁਤ ਕੁਛ ਯੋਗਾ ਦੇ ਵਿੱਚ ਬਹੁਤ ਕੁਛ ਸਿਖਾਇਆ ਲੋਕਾਂ ਨੂੰ ਲੋਕਾਂ ਦੇ ਰੋਗ ਵੀ ਖਤਮ ਹੋਏ ਆ ਉੱਥੇ ਜਾ ਕੇ ਅਤੇ ਉਹਨਾਂ ਨੇ ਬਹੁਤ ਦਵਾਈਆਂ ਵੀ ਤਿਆਰ ਕੀਤੀਆਂ ਹੋਈਆਂ ਨੇ ਖਾਣ ਪੀਣ ਦੀਆਂ ਵਸਤੂਆਂ ਵੀ ਬਹੁਤ ਅੱਛੀਆ ਸਭ ਤਿਆਰ ਕੀਤੀਆਂ ਹੋਈਆਂ ਨੇ ਉਹਨਾਂ ਦੀਆਂ ਸਭ ਵਸਤੂਆਂ ਅਸੀਂ ਤਿਆਰ ਕੀਤੀਆਂ ਹੋਈਆਂ ਵਰਤਦੇ ਵੀ ਹਾਂ ਅਤੇ ਉਹਨਾਂ ਨੇ ਯੋਗਾ ਦੇ ਵਿੱਚ ਬਹੁਤ ਅੱਛਾ ਰੋਲ ਨਿਭਾਇਆ ਹੋਇਆ ਹੈ